ਮੈਂ ਕੱਲ੍ਹ ਇੱਕ ਸ਼ੋਪ ਆਨਲਾਈਨ ਸ਼ਾਪਿੰਗ 'ਤੇ ਸਾੜੀ ਮੰਗਵਾਈ ਉਹ ਸਾੜੀ ਬਹੁਤ ਹੀ ਵਧੀਆ ਸ ਸੀ ਅਤੇ ਅਠਾਰਾਂ ਸੌ ਉਸ ਦਾ ਮੁੱਲ ਸੀ ਲੇਕਿਨ ਉਹ ਸਾੜੀ ਆਉਣ 'ਤੇ ਮੈਂ ਦੇਖਿਆ ਕਿ ਉਹ ਫਟੀ ਹੋਈ ਹੈ ਫਿਰ ਮੈਂ ਉਸ ਆਨਲਾਈਨ ਸ਼ੋਪਿੰਗ ਐਪ ਉੱਪਰ ਗਈ ਅਤੇ ਮੈਂ ਉਸ ਨੂੰ ਬਦਲੀ ਕਰਵਾਉਣ ਦੀ ਰਿਕੁਐਸਟ ਦੇਖੀ ਉੱਥੇ ਬਹੁਤ ਤਰ੍ਹਾਂ ਦੇ ਰਿਕੁਐਸਟ ਸੀ ਮੈਂ ਆਪਣੀ ਸ਼ੋਪਿੰਗ ਨੂੰ ਬਦਲਣ ਵਾਲੇ ਸ਼ਿਕਾਇਤ ਦੇ ਕਲਿਕ ਕੀਤਾ ਅਤੇ ਫਿਰ ਮੈਂ ਉਹਨਾਂ ਐਪ ਵਾਲਿਆਂ ਨੂੰ ਸਵਾਲ ਪੁੱਛੇ ਕਿ ਇਹ ਮੇਰੀ ਸਾੜੀ ਜਾਂ ਮੇਰੇ ਸਾੜੀ ਕਿਉਂ ਫਟੀ ਹੋਈ ਹੈ ਅਤੇ ਜਿਹੜਾ ਮੈਂ ਸਲੈਕਟ ਕੀਤਾ ਸੀ ਉਹ ਹੀ ਸਾੜੀ ਮੈਨੂੰ ਬਦਲ ਕੇ ਉਹ ਹੀ ਕਲਰ ਮੈਨੂੰ ਮੇਰੇ ਪੁਰਾਣੇ ਮੁੱਲ ਵਿੱਚ ਵਾਪਸ ਦਿੱਤਾ ਜਾਵੇ